ਦੌੜਨ ਤੋਂ ਬਹੁਤ ਵਧੀਆ ਦੌੜਨ ਤੋਂ ਬਾਅਦ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਇਹ ਇਕ ਮੈਂਟਲ ਸੈਟਿਸਫੈਕਸ਼ਨ ਦਿੰਦਾ ਹੈ ਅਤੇ ਸ਼ਰੀਰ ਨੂੰ ਵੀ ਤੰਦਰੁਸਤ ਰੱਖਦਾ ਹੈ ਸਵੇਰੇ ਦੌੜਨ ਤੋਂ ਬਾਅਦ ਪੂਰਾ ਦਿਨ ਬੰਦਾ ਏਨੇਰਜੇਟਿਕ ਰਹਿੰਦਾ ਹੈ ਫ੍ਰੈਸ਼ ਮਹਿਸੂਸ ਕਰਦਾ ਹੈ ਇੱਕ ਅਹਿਸਾਸ ਹੁੰਦਾ ਹੈ ਕੀ ਤੁਸੀਂ ਕੁਛ ਆਪਣੇ ਸਰੀਰ ਦੇ ਆਪਦੇ ਲਈ ਕੀਤਾ ਹੈ ਇਸ ਨਾਲ ਸਵੇਰੇ ਜਲਦੀ ਉੱਠਣ ਵਿੱਚ ਵੀ ਮਦਦ ਮਿਲਦੀ ਹੈ ਡਾਇਟ ਕੰਟਰੋਲ ਦੇ ਵਿੱਚ ਵੀ ਮਦਦ ਮਿਲਦੀ ਹੈ ਵੇਟ ਕੰਟਰੋਲ ਦੇ ਵਿੱਚ ਵੀ ਮਦਦ ਮਿਲਦੀ ਹੈ ਸਵੇਰੇ ਦੌੜਨ ਦੇ ਬਹੁਤ ਜਿਆਦਾ ਫਾਇਦੇ ਹਨ ਇਹ ਤੁਹਾਡੇ ਮਸਲ ਮਾਸ ਨੂੰ ਮੇਨਟੇਨ ਕਰਦਾ ਹੈ ਇਹ ਤੁਹਾਡੀ ਭੁੱਖ ਨੂੰ ਵਧਾਉਂਦਾ ਹੈ ਜੋ ਕੀ ਸਰੀਰ ਦੀ ਬਹੁਤ ਜਿਆਦਾ ਜਰੂਰੀ ਹੈ ਇਹ ਤੁਹਾਡੇ ਜੋਇੰਟਸ ਨੂੰ ਹੈਲਦੀ ਰੱਖਦਾ ਹੈ ਇੱਕ ਫੁਤੀਲਾਪਨ ਲੈ ਕੇ ਆਉਂਦਾ ਹੈ ਸ਼ਰੀਰ ਦੇ ਵਿੱਚ ਜੋ ਕੀ ਸਰੀਰ ਲਈ ਬਹੁਤ ਜਰੂਰੀ ਹੈ ਪਸੀਨਾ ਨਿਕਲਦਾ ਹੈ ਰੰਨਿੰਗ ਨਾਲ ਬਹੁਤ ਜਿਆਦਾ ਜੋ ਕੀ ਬਹੁਤ ਜਿਆਦੀ ਬਿਮਾਰੀਆਂ ਦੀ ਜੜ ਹੈ ਤਾਂ ਰੰਨਿੰਗ ਹਰ ਇੱਕ ਇਨਸਾਨ ਨੂੰ ਕਰਨੀ ਚਾਹੀਦੀ ਹੈ ਵਰਡ ਸਰਵੇ ਦੇ ਅਨੁਸਾਰ ਤੀਹ ਸਾਲਾਂ ਤੋਂ ਬਾਅਦ ਸਿਰਫ ਇੱਕ ਪ੍ਰਸੈਂਟ ਲੋਕੀ ਰਨਿੰਗ ਕਰਦੇ ਹਨ ਜੋ ਕਿ ਬਹੁਤ ਹੀ ਦੁਖਦਾਇਕ ਹੈ ਲੋਕ ਫਿਟਨੈਸ ਨੂੰ ਇਨੀ ਜਿਆਦਾ ਇੰਪੋਰਟੈਂਸ ਨਹੀਂ ਦਿੰਦੇ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਜਦਕਿ ਉਮਰ ਦੇ ਵਧਣ ਦੇ ਨਾਲ ਲੋਕਾਂ ਨੂੰ ਫਿਟਨੈਸ ਤੇ ਜਿਆਦਾ ਧਿਆਨ ਦੇਣਾ ਚਾਹੀਦਾ ਹੈ ਲੋਕ ਆਪਦੇ ਕੰਮਕਾਰਾਂ ਦੇ ਵਿੱਚ ਬਿਜ਼ੀ ਹੋ ਜਾਂਦੇ ਨੇ ਆਪਦੀ ਗ੍ਰਹਿ ਗ੍ਰਸਤੀ ਦੇ ਵਿੱਚ ਬੀਜ਼ੀ ਹੋ ਜਾਂਦੇ ਹਨ ਜਿਸ ਕਰਕੇ ਉਹ ਆਪਦੀ ਫਿਟਨੈਸ ਕਨੀ ਧਿਆਨ ਨਹੀਂ ਦੇ ਪਾਦੇ ਤੇ ਰੰਨਿੰਗ ਫਿਟਨੈਸ ਦਾ ਇੱਕ ਬਹੁਤ ਵਧੀਆ ਜਰੀਆ ਹੈ ਲੋਕਾਂ ਨੂੰ ਰਨਿੰਗ ਨੂੰ ਪਰਸਿਊ ਕਰਦੇ ਰਹਿਣਾ ਚਾਹੀਦਾ ਹੈ ਰੰਨਿੰਗ ਕਮਿਊਨਿਟੀਜ਼ ਬਣਨੀਆ ਚਾਹੀਦੀਆ ਨੇ ਸਰਕਾਰ ਨੂੰ ਕੁਛ ਉਪਰਾਲੇ ਕਰਨੇ ਚਾਹੀਦੇ ਹਨ ਕੀ ਲੋਕ ਫਿਟਨੈਸ ਵੱਲ ਰਨਿੰਗ ਵੱਲ ਥੋੜਾ ਜਿਹਾ ਆਕਰਸ਼ਿਤ ਹੋਣ ਫਿਟਨੈਸ ਕਲੱਬਸ ਬਣਨੇ ਚਾਹੀਦੇ ਨੇ ਫਿਟਨੈਸ ਕਮਿਊਨਿਟੀਜ਼ ਬਣਨੀਆਂ ਚਾਹੀਦੀਆਂ ਨੇ